ਹੈਲੋ ਹੈਲੋ ਸਤਿ ਸ਼੍ਰੀ ਅਕਾਲ ਐਮ ਐਲ ਏ ਸਾਹਿਬ ਵਧੀਆ ਸਰ ਵਧੀਆ ਸਰ ਅਸੀਂ ਸਰ ਢੰਡਾਰੀ ਤੋਂ ਗੱਲ ਕਰਦੇ ਹਾਂ ਜੀ ਹਾਂਜੀ ਸਰ ਮੇਰਾ ਨਾਮ ਗੁਰਮੁਖ ਸਿੰਘ ਆ ਜੀ ਹਾਂਜੀ ਮੈਂ ਤੁਹਾਡਾ ਨਾ ਨੰਬਰ ਲਿਆ ਸੀਗਾ ਹਾਂਜੀ ਸੇਵਾ ਤਾਂ ਜੀ ਓਂ ਸੀਗਾ ਜੀ ਸਾਡੇ ਪਿੰਡ ਵਾਲੀ ਸੜਕ ਨਾਲ ਬਹੁਤ ਖ਼ਰਾਬ ਆ ਜਿਹੜੇ ਪਿੰਡ ਨੂੰ ਰਾਸਤਾ ਨਹੀਂ ਆਉਂਦਾ ਜੀ ਸਾਡੇ ਸਿੰਗਲ ਰੋਡ ਹਾਂਜੀ ਹਾਂਜੀ ਉਹ ਰਾਸਤਾ ਬਹੁਤ ਖ਼ਰਾਬ ਆ ਜੀ ਅਤੇ ਉਹ ਨਾ ਛੇ ਮਹੀਨੇ ਹੋ ਗਏ ਸਾਨੂੰ ਸਰਪੰਚ ਨੂੰ ਕਹਿੰਦੇ ਨੂੰ ਜੀ ਅਤੇ ਸਾਡੇ ਨਰਪਿੰਦਰ ਸਿੰਘ ਹੈ ਜੀ ਨਹੀਂ ਸਰ ਅਸੀਂ ਤਾਂ ਜੀ ਉਹਨੂੰ ਵੋਟਾਂ ਪਾ ਕੇ ਪਛਤਾਏ ਸਰ ਉਹਨੂੰ ਸਰ ਬੋਲਣ ਦੀ ਅਕਲ ਨਹੀਂ ਬਹੁਤ ਵੱਧ ਘੱਟ ਬੋਲਦਾ ਜੀ ਹਾਂਜੀ ਸਰ ਅਸੀਂ ਤਾਂ ਅਸੀਂ ਤਾਂ ਤੁਹਾਨੂੰ ਕੋਲ ਕੀਤੀ ਆ ਜੇ ਕੋਈ ਤੁਹਾਡੀ ਪਾਰਟੀ ਦਾ ਬੰਦਾ ਸਰ ਸਰਪੰਚ ਹਾਂਜੀ ਹਾਂਜੀ ਸਰ ਐੱਮ ਐੱਲ ਏ ਸਾਹਿਬ ਤੁਸੀਂ ਨਾ ਸਾਡੀ ਸੜਕ ਬਣਵਾ ਦਿਓ ਸਾਡੇ ਪਿੰਡ ਨੂੰ ਬਹੁਤ ਲੋੜ ਆ ਜੀ ਠੀਕ ਆ ਜੀ

ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਅਤੇ ਸੜਕ ਦੇ ਨਾਲ ਨਾਲ ਸਰ ਸਾਡੇ ਨਾ ਗਲੀਆਂ ਨਾਲੀਆਂ ਦਾ ਵੀ ਕੰਮ ਹੋਣ ਵਾਲਾ ਹਾਂਜੀ ਸਰਪੰਚ ਸਾਨੂੰ ਬਹਾਨੇ ਲਾਈ ਜਾਂਦੇ ਆ ਜੀ ਜੇ ਅਸੀਂ ਕੁਛ ਜ਼ਿਆਦਾ ਪੁੱਛਦੇ ਹਾਂ ਤਾਂ ਸਾਨੂੰ ਵੱਧ ਘੱਟ ਬੋਲਦੇ ਆ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ

ਠੀਕ ਆ ਜੀ ਸਾਨੂੰ ਤਾਂ ਕੰਮ ਹੋਣਾ ਚਾਹੀਦਾ ਜੀ ਅਸੀਂ ਤਾਂ ਤਾਂ ਕਿਸੇ ਤੱਕ ਹਾਂਜੀ ਸਾਨੂੰ ਤਾ ਸਾਡਾ ਹਾਂਜੀ ਤੁਸੀਂ ਇੱਦਾਂ ਕਰੋ ਅਸੀਂ ਐਤਵਾਰ ਦਾ ਇਕੱਠ ਰੱਖ ਲੈਂਦੇ ਹਾਂ ਜੀ ਤੁਸੀਂ ਸਾਨੂੰ ਆਪਣਾ ਸਮਾਂ ਦਿਓ ਹਾਂਜੀ ਮੈਂ ਅਤੇ ਨਾ ਮੇਰਾ ਨਾਲ ਆ ਮਿੱਤਰ ਆ ਉਹ ਜਰਨੈਲ ਸਿੰਘ ਉਹਨੂੰ ਲੈ ਕੇ ਮੈਂ ਤੁਹਾਡੇ ਦਫ਼ਤਰ ਪਹੁੰਚਦਾ ਜੀ ਕੋਈ ਗੱਲ ਨਹੀਂ ਜੀ ਕ ਚਾਹੇ ਮਹੀਨੇ ਤੱਕ ਹੋ ਜਾਵੇ ਕੋਈ ਸਾਨੂੰ ਨਹੀਂ ਠੀਕ ਹੈ ਹਾਂਜੀ ਹਾਂਜੀ ਠੀਕ ਆ ਠੀਕ ਆ ਐਮ ਐਲ ਏ ਸਾਹਿਬ ਅਸੀਂ ਤਾਂ ਤੁਹਾਡਾ ਬਸ ਬਹੁਤ ਧੰਨਵਾਦ ਕਰਦੇ ਹਾਂ ਜੇ ਤੁਸੀਂ ਸਾਡਾ ਇਹ ਕੰਮ ਕਰਵਾ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਅਸੀਂ ਜਰੂਰ ਆਉਂਦੇ ਹਾਂ ਜੀ ਤੁਹਾਡੇ ਕੋਲ ਹਾਂਜੀ ਜਦੋਂ ਤੁਸੀਂ ਆਏ ਸੀ ਨਾ ਹਾਂਜੀ ਜਦੋਂ ਤੁਸੀਂ ਸਾਡੇ ਪਿੰਡ ਮੈਂ ਕਿਹਾ ਤੁਸੀਂ ਸਾਡੇ ਪਿੰਡ ਚੋਣ ਪ੍ਰਚਾਰ ਦੇ ਲਈ ਆਏ ਸੀਗੇ ਓਦੋਂ ਤੁਸੀਂ ਕਹਿ ਕੇ ਗਏ ਸੀਗੇ ਬਈ ਜੋ ਵੀ ਕੰਮ ਹੋਇਆ ਸਾਨੂੰ ਜ਼ਰੂਰ ਦੱਸਿਓ ਅਸੀਂ ਸੋਚਿਆ ਵੀ ਐਮ ਐਲ ਏ ਸਾਹਿਬ ਤੱਕ ਅਪਰੋਚ ਕੀਤੀ ਜਾਵੇ ਸਰਪੰਚ ਸਾਹਿਬ ਤਾਂ ਸਾਡਾ ਕਹਿਣਾ ਘੱਟ ਮੰਨਦੇ ਆ ਜੀ ਹਾਂਜੀ ਪਿੰਡ ਦਾ ਸਾਂਝਾ ਕੰਮ ਆ ਅਸੀਂ ਕਿਹਾ ਵੀ ਚਲੋ ਐਮ ਐਲ ਏ ਸਾਹਿਬ ਨਾਲ ਹਾਂਜੀ ਇੱਕ ਸਾਡੀ ਜੀ ਨੌਜਵਾਨ ਸਭਾ ਰਜਿਸਟਰ ਕਰਵਾਉਣੀ ਆ ਅਸੀ ਉਹਦੀ ਵੀ ਸਾਡੀ ਮਦਦ ਜ਼ਰੂਰ ਕਰਿਓ ਚਲੋ ਠੀਕ ਆ ਐੱਮ ਐੱਲ ਏ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਹਾਂਜੀ ਐਮ ਐਲ ਏ ਸਾਹਿਬ ਓਕੇ ਜੀ ਅਤੇ ਧੰਨ ਧੰਨਵਾਦ ਜੀ